ਹਾਂਜੀ ਮੈਂ ਬਚਪਨ ਦੇ ਵਿੱਚ ਸ਼ੁਰੂ ਤੋਂ ਹੀ ਆਪਣੇ ਦਾਦਾ ਦਾਦੀ ਦੇ ਕੋਲੋਂ ਇਤਿਹਾਸ ਦੇ ਬਾਰੇ ਕਾਫ਼ੀ ਜ਼ਿਆਦਾ ਕਹਾਣੀਆਂ ਸੁਣਦਾ ਹੁੰਦਾ ਸੀਗਾ ਅਤੇ ਉਹ ਕਹਾਣੀਆਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਲੱਗਦੀਆਂ ਸਨ ਅਕਸਰ ਮੇਰੇ ਦਾਦੀ ਜੀ ਮੈਨੂੰ ਰਾਮ ਦੀ ਅਤੇ ਉਹ ਭੀਲਣੀ ਦੇ ਬਾਰੇ ਜਿਹੜੀ ਕਹਾਣੀ ਸੁਣਾਉਂਦੇ ਰਹਿੰਦੇ ਸਨ ਵੀ ਵੀ ਜਿਹੜੀ ਭਗਤੀ ਹੈਗੀ ਇਹ ਉਹ ਜਾਤ ਪਾਤ ਨਹੀਂ ਦੇਖਦੀ ਭਗਤੀ ਦੇ ਨਾਲ ਕੀ ਹੈਗੇ ਜਿਹੜਾ ਪ੍ਰਭੂ ਹੈਗਾ ਪ੍ਰਭੂ ਨੇ ਉਸ ਜਿਹੜੀ ਆਪਣੀ ਫੀਲ ਔਰਤ ਸੀਗੀ ਇੱਕ ਛੋਟੀ ਕਾਸਟ ਨੂੰ ਬਿਲੋਂਗ ਕਰਦੀ ਸੀਗੀ ਵਿਚਾਰੀ ਉਹਦੇ ਜੂਠੇ ਬੇਰ ਵੀ ਖਾ ਲਏ ਤਾਂ ਮੈਂ ਇਹ ਹੀ ਸਿੱਖਿਆ ਹੈਗਾ ਜਿਹੜਾ ਸਾਨੂੰ ਕਿਸ ਤਰ੍ਹਾਂ ਨਫ਼ਰਤ ਨਹੀਂ ਕਰਨੀ ਚਾਹੀਦੀ ਵੀ ਹਰ ਇੱਕ ਨਾਲ ਪਿਆਰ ਕਰਨਾ ਚਾਹੀਦਾ ਭਾਵੇਂ ਦੇਖੋ ਉਹ ਤਾਂ ਇੱਕ ਭਗਵਾਨ ਸੀਗੇ ਪਰ ਉਹਨਾਂ ਨੇ ਇੱਕ ਛੋਟੀ ਕਾਸਟ ਦੀ ਲੇਡੀਜ ਤੋਂ ਬੇਰ ਲੈ ਕੇ ਖਾਦੇ ਤਾਂ ਜਿਹੜਾ ਮੈਂ ਬ੍ਰਾਹਮਣ ਹੋਣ ਦੇ ਨਾਤੇ ਅਸੀਂ ਸਾਡੇ ਘਰ ਦੇ ਵਿੱਚ ਵੀ ਸੀਗਾ ਜਾਤ ਪਾਤ ਦਾ ਅਸੀਂ ਛੋਟੀ ਕਾਸਟ ਦਾ ਨਹੀਂ ਖਾਂਦੇ ਸੀ ਜਦੋਂ ਕਿ ਹੁਣ ਮੈਂ ਵੱਡਾ ਹੋ ਗਿਆ ਅਤੇ ਮੈਂ ਇਹ ਸਾਰੀਆਂ ਚੀਜ਼ਾਂ ਤੋਂ ਦੂਰ ਹੈ ਵੀ ਮੈਨੂੰ ਤਾਂ ਵੀ ਬੰਦਾ ਵਧੀਆ ਹੋਵੇ ਹਰ ਇੱਕ ਦਾ ਖਾ ਲਈਦਾ ਹੈਗਾ ਕਿਉਂਕਿ ਇੱਦਾਂ ਨਹੀਂ ਵੀ ਸਾਨੂੰ ਕਿਸੇ ਨੂੰ ਛੋਟੀ ਕਾਸਟ ਕਹਿ ਕੇ ਵੀ ਉਹਦਾ ਛੱਡ ਦੇਣੀ ਬਿਲਕੁਲ ਨਹੀਂ ਐਨ ਪੂਰੇ ਮਜ਼ੇ ਨਾਲ ਖਾਓ ਜਦੋਂ ਅਗਲਾ ਮਾਣ ਦੇ ਨਾਲ ਖਲਾ ਖਵਾਉਂਦਾ ਹੈਗਾ ਤਾਂ ਖਾਓ ਤਾਂ ਉਸ ਕਹਾਣੀ ਦਾ ਮੇਰੇ ਉੱਪਰ ਬਹੁਤ ਵਧੀਆ ਪ੍ਰਭਾਵ ਪਿਆ ਥੈਂਕ ਯੂ